ਮੈਂ ਬਲਜੀਤ ਕੌਰ ਮੈਂ ਮੀਸ਼ੋ 'ਤੇ ਹੀ ਕੁਝ ਨਾ ਕੁਝ ਪ੍ਰੋਡਕਟ ਖਰੀਦਦੀ ਰਹਿੰਦੀ ਹਾਂ ਇਸ ਵਾਰ ਵੀ ਮੈਂ ਆਪਣੀ ਸਹੇਲੀ ਲਈ ਉਸ ਦੇ ਜਨਮਦਿਨ 'ਤੇ ਗਿਫ਼ਟ ਕਰਨ ਲਈ ਕੋਈ ਵਧੀਆ ਤੋਹਫ਼ਾ ਮੀਸ਼ੋ ਐਪ ਤੋਂ ਲੱਭ ਰਹੀ ਸੀ ਮੈਨੂੰ ਬਹੁਤ ਕੁਝ ਪਸੰਦ ਆਇਆ ਪਰ ਮੇਰੇ ਕੋਲ ਹਜੇ ਇੰਨੇ ਪੈਸੇ ਨਹੀਂ ਸੀ ਅਤੇ ਉਸ ਦੇ ਜਨਮਦਿਨ ਵਿੱਚ ਵੀ ਕੁਝ ਦਿਨ ਪਏ ਸੀ ਤਾਂ ਮੈਂ ਸੋਚਿਆ ਵੀ ਜਦੋਂ ਮੇਰੇ ਕੋਲ ਪੈਸੇ ਆ ਜਾਣਗੇ ਤਾਂ ਮੈਂ ਉਸ ਲਈ ਵਧੀਆ ਜਿਹਾ ਤੋਹਫ਼ਾ ਖਰੀਦ ਕੇ ਉਸ ਨੂੰ ਗਿਫ਼ਟ ਕਰ ਦੇਵਾਂਗੀ ਤਾਂ ਇਸ ਲਈ ਮੈਂ ਬਹੁਤ ਸਾਰੀਆਂ ਚੀਜ਼ਾਂ ਕਾਟ 'ਚ ਪਾ ਦਿੱਤੀਆਂ ਅੱਜ ਵੀ ਅੱਜ ਜਦੋਂ ਮੈਂ ਦੁਬਾਰਾ ਮੀਸ਼ੋ ਨੂੰ ਖੋਲ੍ਹਿਆ ਤਾਂ ਉਹ ਉੱਥੇ ਉਸ ਤੋਂ ਵੀ ਜ਼ਿਆਦਾ ਵਧੀਆ ਚੀਜ਼ਾਂ ਆਈਆਂ ਹੋਈਆਂ ਸਨ ਤਾਂ ਮੈਂ ਕਾਟ ਵਿੱਚ ਜਾ ਕੇ ਜੋ ਚੀਜ਼ਾਂ ਮਹਿੰਗੀਆਂ ਸੀ ਉਹ ਚੀਜ਼ਾਂ ਨੂੰ ਚੁਣ ਚੁਣ ਕੇ ਉੱਥੋਂ ਹਟਾ ਦਿੱਤਾ ਅਤੇ ਉਸ ਲਈ ਇੱਕ ਵਧੀਆ ਜਿਹੀ ਘੜੀ ਨੂੰ ਮੈਂ ਮੰਗਵਾ ਲਿਆ ਜੋ ਕਿ ਸੋਹਣੀ ਵੀ ਬਹੁਤ ਸੀ ਅਤੇ ਉਸ ਦਾ ਪ੍ਰਾਈਜ਼ ਵੀ ਲੋਅ ਸੀ